ਜਿਹੜੇ ਵਿਅਕਤੀ ਨੇ ਤੈਰਨਾ ਸਿੱਖਣਾ ਸ਼ੁਰੂ ਕੀਤਾ ਅ ਕਰਨਾ ਹੋਵੇ ਉਹਦੇ ਲਈ ਇਹੋ ਹੀ ਸਲਾਹ ਹੈ ਕਿ ਉਸ ਬੰਦੇ ਨੂੰ ਸਭ ਤੋਂ ਪਹਿਲੇ ਆਪਣੇ ਆਪ ਹੀ ਕਿਸੇ ਉਸ ਜਗ੍ਹਾ 'ਤੇ ਨਹੀਂ ਚਲੇ ਜਾਣਾ ਚਾਹੀਦਾ ਜਿੱਥੇ ਸਿੱਧਾ ਹੀ ਕਹੇ ਮੈਂ ਤਾਂ ਤੈਰ ਲਵਾਂਗਾ ਉਹਨੂੰ ਪਹਿਲਾਂ ਸਵੀਮਿੰਗ ਸੈਂਟਰ ਜਾਣਾ ਚਾਹੀਦਾ ਉੱਥੇ ਜਿਹੜੇ ਕੋਚ ਹੁੰਦੇ ਆ ਉਨ੍ਹਾਂ ਕੋਲੋਂ ਟ੍ਰੇਨਿੰਗ ਲੈਣੀ ਚਾਹੀਦੀ ਹੈ ਉਨ੍ਹਾਂ ਦੀ ਸਲਾਹ ਨਾਲ ਜਿਸ ਤਰੀਕੇ ਦੇ ਨਾਲ ਉਹ ਉਨ੍ਹਾਂ ਨੂੰ ਜਿਹੜੇ ਸਟੈਪ ਬਾਏ ਸਟੈੱਪ ਉਹ ਸਿਖਾਉਣਗੇ ਅਤੇ ਉਹਦੇ ਨਾ ਉਸੇ ਤਰ੍ਹਾਂ ਹੀ ਉਨ੍ਹਾਂ ਨੂੰ ਜਿਹੜੀ ਹੈ ਸਵਿਮਿੰਗ ਸਿੱਖਣੀ ਚਾਹੀਦੀ ਹੈ ਅਤੇ ਉਸ ਤੋਂ ਬਾਅਦ ਵੀ ਉਹਨੂੰ ਚਾਹੀਦਾ ਹੈ ਕਿ ਜਦੋਂ ਉਸ ਤੋਂ ਬਾਅਦ ਉਹ ਕਿਤੇ ਕਿਸੇ ਓਪਰੀ ਜਗ੍ਹਾ 'ਤੇ ਵੀ ਜਾਵੇ ਤਾਂ ਉਹਨੂੰ ਆਪਣੇ ਜਿਹੜੇ ਨੇ ਸਰਫਿੰਗ ਬੂਟਸ ਜਾਂ ਲਾਈਫ ਜੈਕੇਟਸ ਨੂੰ ਨਾਲ ਲੈ ਲੈ ਕੇ ਈ ਜਾਵੇ ਉਹ ਏਅਰ ਟਿਊਬਸ ਹੁੰਦੀਆਂ ਜੋ ਵੀ ਇਹਨਾਂ ਤਰੀਕੇ ਹੁੰਦੇ ਨੇ ਇਹਨਾਂ ਦੇ ਜਾਂ ਚੀਜ਼ਾਂ ਹੁੰਦੀਆਂ ਨੇ ਉਨ੍ਹਾਂ ਦੇ ਨਾਲ ਹੀ ਉਸ ਨੂੰ ਆਪਣੀ ਇਹ ਸਵਿਮਿੰਗ ਸ਼ੁਰੂ ਕਰ ਦੇਣੀ ਚਾਹੀਦੀ ਹੈ ਏ ਅਤੇ ਆਪਣੇ ਆਪ ਰਿਸਕ ਨਹੀਂ ਲੈਣਾ ਚਾਹੀਦਾ ਹੈ ਕਿ ਅਸੀਂ ਚਲੋ ਜੀ ਮੈਂ ਵਿੱਚ ਵੜ ਗਿਆ ਇੱਕ ਛਲਾਂਗ ਮਾਰਾਂਗਾ ਅਤੇ ਮ ਮੈਨੂੰ ਸਵਿਮਿੰਗ ਆ ਜਾਏਗੀ ਇਹਦੇ ਲਈ ਪਹਿਲਾਂ ਪੂਲਜ਼ ਦੇ ਵਿੱਚ ਜਾਵੇ ਥੋੜ੍ਹੀਆਂ ਥੋੜ੍ਹੀਆਂ ਚੀਜ਼ਾਂ ਤੋਂ ਕਰੇ ਉਸ ਤੋਂ ਬਾਅਦ ਹੀ ਉਸ ਨੂੰ ਐਂ ਤੈਰਨਾ ਸਿੱਖਣਾ ਸ਼ੁਰੂ ਕਰਨਾ ਚਾਹੀਦਾ ਹੈ